ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਲੋਹੜੀ ਬਸੰਤ ਵਿਸਾਖੀ ਰੱਖੜੀ ਦੁਸ਼ਹਿਰਾ ਦਿਵਾਲੀ ਇਹ ਭਾਰਤ ਦੇ ਮਹੱਤਵਪੂਰਨ ਤਿਉਹਾਰ ਹਨ ਸਭ ਤੋਂ ਪਹਿਲਾਂ ਜਿਹੜੀ ਸ਼ ਸਾਲ ਦੀ ਸ਼ੁਰੂਆਤ ਹੈ ਉਹ ਲੋਹੜੀ ਅਤੇ ਮਾਘੀ ਨਾਲ ਹੁੰਦੀ ਹੈ ਲੋਹੜੀ ਵਾਲੇ ਦਿਨ ਲੋਹੜੀ ਬਾਲੀ ਜਾਂਦੀ ਹੈ ਮੂੰਗਫਲੀਆਂ ਰੇਵੜੀਆਂ ਵੰਡੀਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਬਸੰਤ ਦਾ ਤਿਉਹਾਰ ਆਉਂਦਾ ਹੈ ਜਦੋਂ ਕਹਿੰਦੇ ਕਿ ਆਈ ਬਸੰਤ ਪਾਲਾ ਉੜੰਤ ਤਾਂ ਕਿ ਉਦੋਂ ਠੰਡ ਥੋੜ੍ਹੀ ਘੱਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਲੋਕ ਇਸ ਦਿਨ ਪਤੰਗ ਉਡਾਉਂਦੇ ਹਨ ਉਸ ਤੋਂ ਬਾਅਦ ਜਦੋਂ ਵਾਢੀ ਮੁੱਕਣ 'ਤੇ ਆ ਜਾਂਦੀ ਹੈ ਫਿਰ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜੱਟ ਆਪਣੀ ਸਾਰੀ ਆਪਣੀ ਫਸਲ ਕੱਟ ਕੇ ਵੱਢ ਕੇ ਵੇਚ ਕੇ ਵਿਹਲਾ ਹੋ ਜਾਂਦਾ ਹੈ ਅਤੇ ਫਿਰ ਇਸ ਖੁਸ਼ੀ ਦੇ ਵਿੱਚ ਉਹ ਵਿਸਾਖੀ ਦਾ ਤਿਉਹਾਰ ਮਨਾਉਂਦਾ ਹੈ ਅਤੇ ਵਿਸਾਖੀ ਦਾ ਤਿਉਹਾਰ ਜਿਹੜਾ ਹੈ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਸੰਬੰਧਿਤ ਹੈ ਉਸ ਦਿਨ ਉਹਨਾਂ ਨੇ ਸਿੱਖ ਧਰਮ ਦੀ ਜਿਹੜੀ ਹੈਗੀ ਉਹ ਨੀਂਹ ਰੱਖੀ ਸੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਸ ਤੋਂ ਬਾਅਦ ਤੁਹਾਡਾ ਰੱਖੜੀ ਦਾ ਜਿਹੜਾ ਮੇਨ ਤਿਉਹਾਰ ਆਉਂਦਾ ਹੈ ਰੱਖੜੀ ਦੇ ਤਿਉਹਾਰ 'ਤੇ ਜਿਹੜੀ ਭਰਾ ਅਤੇ ਭੈਣ ਦੇ ਪਿਆਰ ਦਾ ਪ੍ਰਤੀਕ ਹੈ ਰੱਖੜੀ ਜਿਹੜੀ ਭੈਣ ਏ ਆਪਣੇ ਭਰਾ ਦੇ ਰੱਖੜੀ ਬੰਨਦੀ ਹੈ ਅਤੇ ਭਰਾ ਫਿਰ ਉਸਨੂੰ ਉਸਦੇ ਬਦਲੇ ਕੁਝ ਸ਼ਗਨ ਦਿੰਦਾ ਹੈ ਉਸ ਤੋਂ ਬਾਅਦ ਦੁਸ਼ਹਿਰੇ ਦਾ ਤਿਉਹਾਰ ਆਉਂਦਾ ਹੈ ਦੁਸ਼ਹਿਰੇ ਦੇ ਤਿਉਹਾਰ ਵਾਲੇ ਦਿਨ ਬਾਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ ਲੋਕ ਮਿਠਾਈਆਂ ਖਰੀਦਦੇ ਹਨ ਪਟਾਕੇ ਚਲਾਉਂਦੇ ਹਨ ਅਤੇ ਰਾਵਣ ਦੇ ਪੁਤਲੇ ਨੂੰ ਫੂਕਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਜਿਹੜਾ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਹ ਦਿਵਾਲੀ ਦਾ ਤਿਉਹਾਰ ਹੈ ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਹ ਸ਼੍ਰੀ ਰਾਮ ਚੰਦਰ ਜੀ ਬਣਵਾਸ ਕੱਟ ਕੇ ਸੀਤਾ ਅਤੇ ਲਕਛਮਣ ਜੀ ਨਾਲ ਵਾਪਸ ਆਏ ਸੀਗੇ ਅਤੇ ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਿਹੜੇ ਸਿੱਖਾਂ ਦੇ ਛੇਵੇਂ ਗੁਰੂ ਸੀਗੇ ਉਹ ਵੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਬਵੰਜਾ ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਸਨ ਅਤੇ ਦਿਵਾਲੀ ਜਿਹੜੀ ਹੈਗੀ ਹੈ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਹੈਗੀ ਹੈ ਦੀਪਮਾਲਾ ਕੀਤੀ ਜਾਂਦੀ ਹੈ ਸਾਰੇ ਘਰਾਂ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਲੈ ਕੇ ਆਉਂਦੇ ਹਨ ਨਵੇਂ ਨਵੇਂ ਕੱਪੜੇ ਪਾਉਂਦੇ ਹਨ ਅਤੇ ਬਹੁਤ ਜ਼ਿਆਦਾ ਆਤਿਸ਼ਬਾਜੀ ਅਤੇ ਪਟਾਕੇ ਚਲਾਏ ਜਾਂਦੇ ਹਨ ਅਤੇ ਜਿਹੜੀਆਂ ਭਾਰਤ ਦੇ ਵਿੱਚ ਦੋ ਮਹੱਤਵਪੂਰਨ ਛੁੱਟੀਆਂ ਨੇ ਉਹ ਹਨ ਪੰਦਰ੍ਹਾਂ ਅਗਸਤ ਤੇ ਛੱਬੀ ਜਨਵਰੀ ਇਹ ਜਿਹੜੀਆਂ ਹੈਗੀਆਂ ਆਪਣੀਆਂ ਰਾਸ਼ਟਰੀ ਛੁੱਟੀਆਂ ਹਨ ਪੰਦਰ੍ਹਾਂ ਅਗਸਤ ਨੂੰ ਭਾਰਤ ਜਿਹੜਾ ਹੈ ਆਜ਼ਾਦ ਹੋਇਆ ਸੀਗਾ ਅਤੇ ਛੱਬੀ ਜਨਵਰੀ ਦੇ ਵਿੱਚ ਛੱਬੀ ਜਨਵਰੀ ਨੂੰ ਜਿਹੜਾ ਰਿਪਬਲਿਕ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਗਣਤੰਤਰ ਦਿਵਸ ਜਿਸ ਨੂੰ ਆਪਾਂ ਕਹਿੰਦੇ ਹਨ